ਹਾਂਜੀ ਮੈਂ ਦੂਜੇ ਰਾਜੇ ਵਿੱਚ ਜਾ ਕੇ ਆਪਣਾ ਕਾਫ਼ੀ ਜ਼ ਭਾਸ਼ਾ ਦੀ ਬਹੁਤ ਦਿੱਕਤ ਆਉਂਦੀ ਹੈ ਅਤੇ ਕਈ ਵਾਰ ਮੈਂ ਇਸ਼ਾਰਿਆਂ ਨਾਲ ਵੀ ਸਮਝਾਉਣਾ ਪੈਂਦਾ ਹੈ ਅਤੇ ਕਈ ਵਾਰ ਮੈਂ ਗੂਗਲ ਦਾ ਸਹਾਰਾ ਬਹੁਤ ਲੈਂਦਾ ਹਾਂ ਜ਼ਿਆਦਾਤਰ ਗੂਗਲ ਤੋਂ ਹੀ ਸਹਾਰਾ ਲਿੱਤਾ ਜਾਂਦਾ ਵਾ ਗੂਗਲ ਮੈਨੂੰ ਸਭ ਕੁਝ ਦੱਸ ਦਿੰਦਾ ਹਾਂ ਕਿਸ ਭਾਸ਼ਾ ਦੀ ਕੀ ਵਲਡਿੰਗ ਆ ਉਹਨਾਂ ਨੇ ਕੀ ਮੈਨੂੰ ਕਿਹਾ ਮੈਂ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਕੀ ਸਮਝਾਉਣਾ ਚਾਹੁੰਦਾ ਹਾਂ ਮੈਂ ਗੂਗਲ ਤੋਂ ਸਹਾਰਾ ਲੈ ਕੇ ਉਹਨਾਂ ਨਾ ਗੱਲ ਕਰ ਲੈਂਦਾ ਪੂਰੀ ਪ੍ਰੋਪਰ ਗੱਲ ਹੁੰਦੀ ਆ ਮੈਂ ਕਾਫ਼ੀ ਰਾਜਿਆਂ 'ਚ ਜਾਂਦਾ ਹਾਂ ਕਾਫ਼ੀ ਯਾਨੀ ਕਿ ਭਾਸ਼ਾ ਦਾ ਉਪਯੋਗ ਕਰਨ ਨੂੰ ਕਰਨਾ ਪੈਂਦਾ ਵਾ ਦਿੱਕਤ ਆਉਂਦੀ ਹੈ ਫਿਰ ਮੈਂ ਗੂਗਲ ਦਾ ਸਹਾਰਾ ਲੈਂਦਾ ਹਾਂ ਕੁਛ ਇਸ਼ਾਰਿਆਂ ਨਾਲ ਹੁੰਦੀ ਹੈ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਸਭ ਕੁੱਝ ਦੱਸਦਾ ਹਾਂ ਜੀ ਅਤੇ ਕਾਫ਼ੀ ਉਹ ਨ ਕੋਈ ਯਾਨੀ ਕਿ ਗੂਗਲ ਤੋਂ ਸਹਾਰਾ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਉੱਦਾਂ ਕਈ ਰਾਜਿਆਂ 'ਚ ਜਾ ਕੇ ਪਰੇਸ਼ਾਨੀ ਹੁੰਦੀ ਹੈ ਸਾਨੂੰ ਅਤੇ ਕਾਫ਼ੀ ਗਾਈਡ ਹੈ ਗੂਗਲ ਹੀ ਸਾਨੂੰ ਕਰ ਕਰਦਾ ਹੈ ਜੀ